ਹੈਲੋ ਹਾਂਜੀ ਮਨਜੀਤ ਬੁੱਕ ਸ਼ੌਪ ਤੋਂ ਬੋਲ ਰਹੇ ਹਾਂਜੀ ਹਾਂਜੀ ਸਰ ਮੈਨੂੰ ਨਾ ਬੁੱਕਸ ਚਾਹੀਦੀਆ ਸੀ ਮੈਂ ਜਿਸ ਤਰ੍ਹਾਂ ਨਾ ਬੀ ਐਡ ਕੋਲੇਜ ਟੀਚ ਕਰਦੀ ਹਾਂ ਅਤੇ ਇੱਕ ਬੁੱਕ ਮੈਨੂੰ ਚਾਹੀਦੀ ਏ ਅੰਡਰਸਟੈਡਿੰਗ ਲਰਨਰ ਅਤੇ ਇੱਕ ਚਾਹੀਦੀ ਮੈਨੂੰ ਐਜੂਕੇਸ਼ਨ ਡਿਵੈ ਡਿਵੈਲਪਮੈਂਟ ਦੀ ਇਹ ਮੈਨੂੰ ਮੈਂ ਜਿਸ ਤਰ੍ਹਾਂ ਮੈਨੂੰ ਤਿੰਨੋ ਮੀਡੀਅਮ 'ਚ ਚੀਹੀਦੀ ਬੁੱਸਕ ਪੰਜਾਬੀ ਹਿੰਦੀ ਅਤੇ ਇੰਗਲਿਸ਼ ਵਿੱਚ ਠੀਕ ਏ ਅਤੇ ਮੈਂ ਦੂਸਰਾ ਪੁੱਛਣਾ ਚਾਹੁੰਦੀ ਜਿਸ ਤਰ੍ਹਾਂ ਮੈਂ ਟੀਚਰ ਅਤੇ ਮੈਨੂੰ ਕੋਈ ਕਨਸੈਸ਼ਨ ਮਿਲੇਗੀ ਕੋਈ ਔਫ ਡਿਸਕਾਊਂਟ ਵਗੈਰਾ ਅੱਛਾ ਜੀ

ਅੱਛਾ ਜੀ ਠੀਕ ਏ ਜੀ ਠੀਕ ਏ ਜੀ ਠੀਕ ਏ ਜੀ ਕੋਈ ਗੱਲ ਨਹੀਂ ਸਰ ਮੈਂ ਪਰਸਨਲ ਪ ਮੈਂ ਆਪਣਾ ਐਡਰੈਸ ਕਰਦਾਂਗੀ ਤੁਸੀਂ ਫ਼ਿਰ ਮੈਨੂੰ ਹੈ ਨਾ ਬਾਏ ਪੋਸਟ ਭੇਜ ਦੇਣਾ ਸਾਰੇ ਬੁਕਸ

ਅੱਛਾ ਜੀ ਅੱਛਾ ਜੀ ਠੀਕ ਏ ਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਮੇਰਾ ਔਡਰ ਫਿਰ ਨੋਟ ਕਰ ਲਓ ਹਾਂਜੀ ਹਾਂਜੀ ਅਤੇ ਇਹ ਫਿਰ ਠੀਕ ਏ ਜੀ ਠੀਕ ਮੈਂ ਤੁਹਾਨੂੰ ਆਪਣਾ ਐਡਰੈਸ ਨੋਟ ਕਰਵਾ ਦਿੰਨੀ ਆ ਅਤੇ ਫ਼ਿਰ ਤੁਸੀਂ ਮੇਰਾ ਨਾਲ ਜੋ ਵੀ ਮੇਰਾ ਔਡਰ ਆਵੇਗਾ ਨਾ ਉਹ ਫ਼ਿਰ ਤੁਸੀਂ ਮੈਨੂੰ ਪੋਸਟ ਕਰ ਦਿਓ ਠੀਕ ਹੈ

ਪਤਾ ਫ਼ਿਰ ਗੂਗਲ ਪੇਅ ਕਰਦਾਂਗੀ ਹਾਂਜੀ ਹਾਂਜੀ ਹਾਂਜੀ ਜਿਸ ਤਰ੍ਹਾਂ ਮੇਰਾ ਬੇਟਾ ਪੜ੍ਹਦਾ ਫਿਰ ਓਹਦੀ ਜਿਵੇਂ ਕਮਰਸ ਫਿਲਡ 'ਚ ਉਹ ਵਾਲੀ ਬੁਕਸ ਮੈਂ ਫਿਰ ਤੁਹਾਨੂੰ ਔਡਰ ਕਰਦਾਂਗੀ ਠੀਕ ਹੈ ਜੀ ਠੀਕ ਠੀਕ ਏ ਜੀ ਓਕੇ ਥੈਂਕ ਯੂ ਜੀ